ਪੰਜ ਫਰਵਰੀ ਉੱਨੀ ਸੌ ਸਤਾਨਵੇਂ ਅਠਾਰ੍ਹਾਂ ਅਕਤੂਬਰ ਦੋ ਹਜ਼ਾਰ ਤੇਈ ਨੌ ਅਕਤੂਬਰ ਉੱਨੀ ਸੌ ਸਤਾਨਵੇਂ ਇੱਕੀ ਸਤੰਬਰ ਦੋ ਹਜ਼ਾਰ ਛੇ ਗਿਆਰ੍ਹਾਂ ਅਗਸਤ ਦੋ ਹਜ਼ਾਰ ਇੱਕ